ਹਾਂਜੀ ਮੈਂ ਮੈਰਾਥੋਨ ਅਤੇ ਲੰਬੀ ਰੇਸ ਵਿੱਚ ਭਾਗ ਲਿਆ ਸੀ ਸਾਡੇ ਸਕੂਲ ਵਾਲਿਆਂ ਨੇ ਸਾਨੂੰ ਬਹੁਤ ਚੰਗੀ ਤਿਆਰੀ ਕਰਾਈ ਸੀ ਇਸ ਵਾਸਤੇ ਸਾਨੂੰ ਪਹਿਲਾਂ ਸਾਡਾ ਸਟਾਮਿਨਾ ਉਹਨਾਂ ਨੇ ਵਧਾਇਆ ਸੀ ਸਾਨੂੰ ਗਰਾਊਂਡ ਵਿੱਚ ਦਸ ਤੋਂ ਵੀਹ ਚੱਕਰ ਲਵਾਉਂਦੇ ਰੋਜ਼ ਦੇ ਅਤੇ ਫਿਰ ਡੀ ਪੀ ਸਰ ਸਾਨੂੰ ਮੇਨ ਸੜਕ 'ਤੇ ਭਜਾਉਣ ਲੈ ਕੇ ਜਾਂਦੇ ਫਿਰ ਘੰਟਾ ਸਾਈਕਲਿੰਗ ਕਰਾਉਂਦੇ ਅਤੇ ਸਾਡੀ ਡਾਇਟ ਪਲਾਨ ਵੀ ਚੇਂਜ ਕਰ ਦਿੱਤਾ ਸੀ ਉਹਨਾਂ ਨੇ ਸਾਰਾ ਫਾਸਟ ਫੂਡ ਸਾਡੀ ਡਾਇਟ 'ਚੋਂ ਬੰਦ ਕਰ ਦਿੱਤਾ ਸੀ ਅਤੇ ਪਾਣੀ ਥੋੜ੍ਹਾ ਜਿਹਾ ਸ਼ਾਮਿਲ ਕੀਤਾ ਸੀ ਪਰ ਪਾਣੀ ਬਹੁਤ ਮਾਤਰਾ ਵਿੱਚ ਨਹੀਂ ਪੀਣਾ ਸੀ ਕਿਉਂਕਿ ਜੇ ਜੇਕਰ ਅਸੀਂ ਭੱਜਦੇ ਸਾਡੀ ਕਿਡਨੀ 'ਚ ਵੀ ਜ਼ਿਆਦਾਤਰ ਇਫੈਕਟ ਪੈਂਦਾ ਸੀ ਅਤੇ ਲੀਵਰ ਉਸਨੂੰ ਡਾਈਜੈਸਟ ਨਹੀਂ ਕਰ ਸਕਦਾ ਸੀ ਅਤੇ ਜੇਕਰ ਅਸੀਂ ਥੋੜ੍ਹਾ ਜਿਹਾ ਵੀ ਫੈਟ ਵਾਲਾ ਖਾਣਾ ਖਾ ਲੈਂਦੇ ਸੀ ਉਸ ਨਾਲ ਅਗਲੇ ਦਿਨ ਭੱਜਿਆ ਨਹੀਂ ਜਾਂਦਾ ਸੀ ਅਤੇ ਸਾਹ ਚੜ੍ਹਦਾ ਸੀ ਤਾਂ ਕਰਕੇ ਸਾਹ ਚੜ੍ਹਾਉਣ ਦੂਰ ਕਰਨ ਲਈ ਉਹਨਾਂ ਨੇ ਸਾਡਾ ਫਾਸਟ ਫੂਡ ਬੰਦ ਕਰਤਾ ਅਤੇ ਸਾਨੂੰ ਦਸ ਤੋਂ ਵੀਹ ਰਾਊਂਡ ਦਿਨ ਦੇ ਕਢਵਾਉਂਦੇ ਸਨ ਅਤੇ ਟਰੈਡਮਿੱਲ ਵੀ ਉਹਨਾਂ ਨੇ ਜ਼ਰੂਰ ਕਿਹਾ ਸੀ ਇਸ ਲਈ ਮੈਂ ਦਿਨ 'ਚ ਡੇਢ ਦੋ ਘੰਟੇ ਟਰੈਡਮਿੱਲ ਵੀ ਕਰਦਾ ਸੀ